ਮੇਰੇ ਦੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਲੋਕ ਕਰਜ਼ਾ ਲੈਂਦੇ ਹਨ ਕਈ ਲੋਕ ਆਪਣੀਆਂ ਜ਼ਰੂਰਤਾਂ ਲਈ ਕਰਜ਼ਾ ਲੈਂਦੇ ਹਨ ਅਤੇ ਕਈ ਲੋਕਾਂ ਨੂੰ ਇਹ ਪੈਸੇ ਲੈਣੇ ਫਜ਼ੂਲ ਹੀ ਸਮਝਦੇ ਹਨ ਸਾਡੇ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਕਰਜ਼ਾ ਲਿਆ ਹੈ ਅਤੇ ਉਹ ਇਸ ਗੱਲ ਨੂੰ ਆਮ ਗੱਲ ਹੀ ਸਮਝਦੇ ਹਨ ਕਰਜ਼ਾ ਲੈਣਾ ਸਾਡੇ ਲਈ ਇੱਕ ਅਜਿਹਾ ਹੋਣਾ ਚਾਹੀਦਾ ਹੈ ਕਿ ਅਸੀਂ ਕਰਜ਼ਾ ਲੈ ਕੇ ਉਸਨੂੰ ਮੁੜ ਵਾਪਿਸ ਦੇਣਾ ਹੈ ਕਰਜ਼ੇ ਲਈ ਬਹੁਤ ਸਾਰੇ ਮਕਸਦ ਹੋ ਸਕਦੇ ਹਨ ਕਈ ਲੋਕ ਕਰਜ਼ਾ ਲੈਣ ਲਈ ਬੈਂਕਾਂ ਨਾਲ ਸੰਪਰਕ ਕਰਦੇ ਹਨ ਅਤੇ ਕਈ ਲੋਕ ਦੂਸਰੇ ਲੋਕਾਂ ਤੋਂ ਵੀ ਕਰਜ਼ਾ ਲੈ ਲੈਂਦੇ ਹਨ ਕਰਜ਼ਾ ਲੈਣਾ ਆਪਣੇ ਕੰਮ ਲਈ ਤਾਂ ਸਹੀ ਹੈ ਪਰ ਫਜ਼ੂਲ ਦਾ ਕਰਜ਼ਾ ਲੈਣਾ ਸਾਡੇ ਲਈ ਸਹੀ ਨਹੀਂ ਹੈ ਕਰਜ਼ੇ ਦੇ ਚੰਗੇ ਪ੍ਰਭਾਵ ਵੀ ਹਨ ਅਤੇ ਮਾੜੇ ਪ੍ਰਭਾਵ ਵੀ ਦੇਖਣ ਨੂੰ ਆਉਂਦੇ ਹਨ ਮਾੜੇ ਪ੍ਰਭਾਵਾਂ ਵਿੱਚ ਆਉਂਦਾ ਹੈ ਕਿ ਜਿਸ ਤਰ੍ਹਾਂ ਕੋਈ ਕਿਸਾਨ ਕਰਜ਼ਾ ਲੈਂਦਾ ਹੈ ਅਤੇ ਉਹ ਕਰਜ਼ਾ ਨਾ ਭਰ ਪਾਉਣ ਦੇ ਕਾਰਨ ਆਪਣੇ ਆਪ ਦੀ ਆਤਮ ਹੱਤਿਆ ਵੀ ਕਰ ਲੈਂਦਾ ਹੈ ਜਿਸ ਦੀ ਇਹ ਮਾੜੇ ਪ੍ਰਭਾਵ ਹਨ